ਸਾਡੇ ਸੱਭਿਆਚਾਰ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਵਿਆਹ ਬਹੁਤ ਮਹੱਤਵਪੂਰਨ ਰਸਮ ਮੰਨੀ ਜਾਂਦੀ ਹੈ ਇਸ ਦੇ ਵਿੱਚ ਅਨੇਕਾਂ ਹੀ ਐਸੇ ਉਹ ਹਨ ਜਿੰਨਾਂ ਨਾਲ ਅਸੀਂ ਸਾਰੇ ਦੱਸ ਸਕਦੇ ਹਾਂ ਵੀ ਵਿਆਹ ਦੇ ਵਿੱਚ ਕਿਵੇਂ ਕਿਵੇਂ ਦੀਆਂ ਰਸਮਾਂ ਕਿਉਂਕਿ ਹਰ ਇੱਕ ਸੱਭਿਆਚਾਰ ਦੇ ਵਿੱਚ ਅਲੱਗ ਅਲੱਗ ਰਸਮਾਂ ਹੁੰਦੀਆਂ ਹਨ ਜੋ ਸਾਡੇ ਸੱਭਿਆਚਾਰ ਦੇ ਵਿੱਚ ਰਸਮ ਹੈ ਉਸ ਦੇ ਵਿੱਚ ਜ਼ਿਆਦਾਤਰ ਇਹ ਹੈ ਵੀ ਸਾਰੇ ਮਠਿਆਈਆਂ ਬਣਦੀਆਂ ਹਨ ਅਤੇ ਮਿੱਠੇ ਨਾਲ ਸੰਬੰਧਿਤ ਲੱਡੂ ਖੁਰਮੇ ਪਕੌੜੀਆਂ ਜਾਂ ਕੁਝ ਹੋਰ ਇੱਦਾਂ ਗੁਲਾਬ ਜਾਮਣ ਬਰਫੀਆਂ ਵਗੈਰਾ ਵੀ ਸਾਡੇ ਵਿਆਹਾਂ ਦੇ ਵਿੱਚ ਬਣਦੀਆਂ ਹਨ ਇਹ ਇਸ ਦੇ ਵਿੱਚ ਸਾਰੇ ਰਿਸ਼ਤੇਦਾਰ ਸਾਰਾ ਭਾਈਚਾਰਾ ਇਕੱਠਾ ਹੁੰਦਾ ਹੈ ਸਾਰੇ ਰਲ ਮਿਲ ਕੇ ਖੁਸ਼ੀ ਮਨਾਉਂਦੇ ਹਨ ਗੀਤ ਸੰਗੀਤ ਵੀ ਬਹੁਤ ਵੱਡੇ ਪੱਧਰ 'ਤੇ ਲਗਾਏ ਜਾਂਦੇ ਹਨ ਅਤੇ ਮਨ ਦੀ ਖੁਸ਼ੀ ਲਈ ਬਹੁਤ ਜ਼ਿਆਦਾ ਆਪਣਾ ਮਨ ਖੁਸ਼ ਕਰਨ ਲਈ ਉਹ ਨੱਚਦੇ ਹਨ ਅਤੇ ਸਾਡਾ ਲੋਕ ਜਿਹੜਾ ਨਾਚ ਹੈਗਾ ਜੀ ਉਹ ਭੰਗੜਾ ਗਿੱਧਾ ਜਿਹੜੀਆਂ ਔਰਤਾਂ ਨੇ ਉਹ ਗਿੱਧਾ ਪਾਉਂਦੀਆਂ ਨੇ ਜਿਹੜੇ ਬੰਦੇ ਹੁੰਦੇ ਹਨ ਉਹ ਇਸ ਵਿੱਚ ਭੰਗੜਾ ਮਨਾ ਕੇ ਪਾ ਕੇ ਖੁਸ਼ੀ ਮਨਾਉਂਦੇ ਹਨ